ਹੈਲੋ

ਹਾਂਜੀ ਹਾਂਜੀ ਤੁਸੀਂ ਕੌਣ ਅੱਛਾ ਜੀ ਓਕੇ ਸਰ ਓਕੇ ਸਰ ਪਰਮਿਸ਼ਨ ਤਾਂ ਹੈਗੀ ਤੁਸੀਂ ਉਹ ਦੱਸੋ ਨਾ ਕਿ ਕਿੰਨੀ ਅਮਾਊਂਟ ਹੈ ਉਹਦੀ ਕਿੰਨਾ ਮਤਲਬ ਕਿੰਨੇ ਪੈਸੇ ਲੱਗਣਗੇ ਓਕੇ ਓਕੇ ਓਕੇ ਓਕੇ ਅਤੇ ਕਿੰਨੇ 'ਚ ਕਦੋਂ ਜਾ ਰਹੀ ਹੈ ਇਹ ਟ੍ਰਿੱਪ ਓਕੇ ਓਕੇ ਸੱਤ ਅੱਠ ਵਜੇ ਤੋਂ ਹੀ ਚਲੋ ਠੀਕ ਆ ਫਿਰ ਤੁਸੀਂ ਸ਼ਰਾਸ਼ ਦਾ ਨਾਮ ਲਿਖ ਲਿਉ ਅਤੇ ਬਾਕੀ ਕੋਈ ਨਾ ਅਤੇ ਜਿਹੜਾ ਤੁਹਾਨੂੰ ਮਤਲਬ ਸਕੂਲ ਆ ਕੇ ਪੈਸੇ ਦੇਣੇ ਪੈਣਗੇ ਜਾਂ ਤੁਹਾਨੂੰ ਮੈਂ ਪੈਸੇ ਟ੍ਰਾਂਸਫਰ ਕਰ ਦਵਾਂ ਓਕੇ ਓਕੇ ਓਕੇ